ਸਾਡੇ ਖੇਤਰ ਵਿੱਚ ਉਪਲਬੱਧ ਸਭ ਤੋਂ ਪ੍ਰਸਿੱਧ ਡਾਟਾ ਪਲਾਨ ਜੀਓ ਅਤੇ ਏਅਰਟੈੱਲ ਦਾ ਹੈ ਸਾਡੇ ਸਾਰੇ ਪਰਿਵਾਰ ਨੇ ਜੀਓ ਵਾਲੇ ਪਲਾਨ ਨੂੰ ਹੀ ਵਧੀਆ ਮੰਨਿਆ ਹੈ ਕਿਉਂਕਿ ਕਿਉਂਕਿ ਉਸ ਉਸ ਵਿੱਚ ਉਸ ਉਨ ਉਸ ਨੂੰ ਕੀ ਘੱਟ ਕੀਮਤ 'ਤੇ ਅਸੀਂ ਲੈ ਸਕਦੇ ਹਾਂ ਅਤੇ ਉਸਨੂੰ ਘੱਟ ਕੀਮਤ 'ਤੇ ਅਸੀਂ ਲੈ ਸਕਦੇ ਹਾਂ ਅਤੇ ਉਸ ਦਾ ਜਿਹੜਾ ਰੇਂਜ ਹੈ ਉਹ ਵੀ ਬਹੁਤ ਵਧੀਆ ਹੈ ਅ ਅਤੇ ਉਸਨੂੰ ਬਹੁਤ ਲੋ ਬਹੁਤ ਲੋਕ ਵੀ ਯੂਜ ਨਹੀਂ ਕਰਦੇ ਇਸ ਲਈ ਉਹਦੇ ਉਹਦੀ ਰੇਂਜ ਬਹੁਤ ਵਧੀਆ ਆ ਜਾਂਦੀ ਹੈ ਅਤੇ ਕੋਈ ਆ ਅੜਿੰਗਾ ਨਹੀਂ ਪੈਂਦਾ ਜੇ ਅਸੀਂ ਕਿਸੇ ਨੂੰ ਕਾਲ ਕਰਦੇ ਆ ਤੇ ਉਸ ਵੀ ਉਸ ਵਿੱਚ ਵੀ ਕੋਈ ਅੜਿੰਗਾ ਨਹੀਂ ਪੈਂਦਾ ਇਸ ਲਈ ਜਿਹੜਾ ਜੀਓ ਪਲੈਨ ਹੈ ਉਹ ਸਾਨੂੰ ਸਭ ਤੋਂ ਵਧੀਆ ਲੱਗਦਾ ਅਸੀਂ ਉਹਨੂੰ ਹੀ ਪਹਿਲ ਦਿੰਦੇ ਹਾਂ ਕਿ ਸਾਰੇ ਉਸ ਨੂੰ ਹੀ ਯੂਜ ਕਰਨ ਕਿਉਂਕਿ ਉਸਦਾ ਜਿਹੜਾ ਸਿਸਟਮ ਹੈ ਉਹ ਬਹੁਤ ਵਧੀਆ ਹੈ ਅਤੇ ਉਹ ਉਹ ਸਾਰੇ ਭਾਰਤ ਵਿੱਚ ਪ੍ਰਸਿੱਧ ਹੈ ਕਿਉਂਕਿ ਉਸ ਉਸ ਵਿੱਚ ਸਭ ਤੋਂ ਵਧੀਆ ਪਲਾਨ ਵਰਤਿਆ ਗਿਆ ਹੈ ਪੋਲਿਸੀਜ ਸਭ ਤੋਂ ਵਧੀਆ ਵਰਤੀਆਂ ਗਈਆਂ ਹਨ ਇਸ ਲਈ ਮੈਂ ਇਹ ਹੀ ਮੰਨਦੀ ਹਾਂ ਕਿ ਜੀਓ ਦਾ ਪਲੈਨ ਹੀ ਸਭ ਤੋਂ ਵਧੀਆ ਹੈ ਅਤੇ ਉਸ ਨੂੰ ਹੀ ਆਪਾਂ ਨੂੰ ਕਰਨਾ ਚਾਹੀਦਾ ਹੈ